ਐਮਾਜੋਨ ਬਹੁਤ ਹੀ ਮਸ਼ਹੂਰ ਸਾਈਟ ਔਨਲਾਈਨ ਪ੍ਰਚੇਜਿੰਗ ਦੇ ਲਈ ਐਮਜੋਨ 'ਤੇ ਬੈਠੇ ਬੈਠੇ ਮੈਂ ਇੱਕ ਦਿਨ ਸਰਫਿੰਗ ਕਰ ਰਿਹਾ ਸੀ ਅਚਾਨਕ ਮੇਰੀ ਨਜ਼ਰ ਬਹੁਤ ਹੀ ਵਧੀਆ ਕੁਆਲਿਟੀ ਦੇ ਹੈਡਫੋਨ 'ਤੇ ਪਈ ਇਹ ਹੈਡਫੋਨ ਬੋਟ ਕੰਪਨੀ ਦੇ ਸਨ ਪ੍ਰੋਡਕਟ ਮੈਨੂੰ ਵਧੀਆ ਲੱਗਾ ਉੱਪਰ ਐਡਵਰਟਾਈਜਮੈਂਟ ਵੀ ਕਾਫੀ ਵਧੀਆ ਕੀਤੀ ਹੋਈ ਸੀਗੀ ਕਿ ਇਸਦੀ ਬੇਸ ਕੁਆਲਿਟੀ ਬਹੁਤ ਵਧੀਆ ਹੈ ਸਾਊਂਡ ਕੁਆਲਿਟੀ ਬਹੁਤ ਵਧੀਆ ਹੈ ਬੈਟਰੀ ਬੈਕਅਪ ਬਹੁਤ ਅੱਛਾ ਹੈ ਇਹ ਸਭ ਕੁਆਲਟੀਆਂ ਦੇਖਦੇ ਹੋਏ ਮੇਰਾ ਪ੍ਰੋਡਕਟ ਖਰੀਦਣ ਨੂੰ ਮੂਡ ਬਣ ਆਇਆ ਉਸ ਟਾਈਮ ਮੈਨੂੰ ਪ੍ਰਾਈਜ ਵੀ ਇਸ ਦਾ ਰੀਜੇਬਲ ਲੱਗਾ ਜਿਸ ਕਰਕੇ ਮੈਂ ਔਡਰ ਕਰ ਦਿੱਤਾ ਚਾਰ ਦਿਨ ਦੇ ਬਾਅਦ ਇਹ ਪ੍ਰੋਡਕਟ ਮੈਨੂੰ ਘਰ ਬੈਠੇ ਹੀ ਮਿਲ ਗਿਆ ਮੈਂ ਪ੍ਰੋਡਕਟ ਲੈ ਕੇ ਬਹੁਤ ਖੁਸ਼ ਸੀ ਕਾਫੀ ਚਿਰ ਦੀ ਤਮੰਨਾ ਸੀ ਕਿ ਮੈਂ ਇੱਕ ਵਧੀਆ ਕੁਆਲਟੀ ਦੇ ਹੈਡਫੋਨ ਲਵਾਂ ਉਸੇ ਟਾਈਮ ਮੈਂ ਪੈਕਿੰਗ ਓਪਨ ਕੀਤੀ ਅਤੇ ਆਪਣੇ ਫੋਨ ਦੇ ਨਾਲ ਹੈਡਫੋਨ ਲਿੰਕ ਕੀਤੇ ਪਹਿਲਾ ਗਾਣਾ ਪਲੇਅ ਕੀਤਾ ਹੈਡਫੋਨ ਮੈਂ ਕੰਨਾਂ ਨੂੰ ਲਗਾਏ ਪਰ ਇਸ ਦੀ ਆਵਾਜ਼ ਕੁਆਲਿਟੀ ਇੰਨੀ ਵਧੀਆ ਨਹੀਂ ਸੀ ਦੇਖਣ 'ਚ ਲੱਗ ਰਿਹਾ ਸੀ ਜਿਸ ਤਰ੍ਹਾਂ ਮਤਲਬ ਪ੍ਰੋਡਕਟ ਓਰੀਜਨਲੀ ਹਨ ਜਾਂ ਸੀ ਫਸਟ ਕਾਪੀ ਹੈ ਉਸ ਤੋਂ ਬਾਅਦ ਮੈਂ ਆਪਣੇ ਦੋਸਤ ਨੂੰ ਫੋਨ ਲਗਾਇਆ ਉਸ ਨਾਲ ਫੋਨ 'ਤੇ ਗੱਲ ਕਰਕੇ ਮੈਂ ਉਸਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਪ੍ਰੋਡਕਟ ਲਿਤਾ ਹੈ ਬਟ ਉਸਨੇ ਉਸੇ ਵੇਲੇ ਮੈਨੂੰ ਅਵਾਜ਼ ਸਾਫ ਨਾ ਆਉਣ ਦੀ ਕੰਪਲੇਂਟ ਕਰ ਦਿੱਤੀ ਮੈਂ ਕੱਟ ਕਰਕੇ ਫੋਨ ਦੁਬਾਰਾ ਲਗਾਇਆ ਫਿਰ ਉਸਨੇ ਮੈਨੂੰ ਅਵਾਜ਼ ਕਲੀਅਰ ਨਾ ਆਉਣ ਦੀ ਦੁਬਾਰਾ ਕੰਪਲੇਂਟ ਕੀਤੀ ਇਸ ਤੋਂ ਬਾਅਦ ਮੈਂ ਫੋਨ ਚੈੱਕ ਕਰਨ ਲਈ ਆਪਣੀ ਮੌਮ ਨੂੰ ਕਾਲ ਕੀਤੀ ਉਹਨਾਂ ਨੇ ਵੀ ਮੈਨੂੰ ਇਹ ਕਿਹਾ ਕਿ ਤੇਰੀ ਅਵਾਜ਼ ਸੁਣਾਈ ਨਹੀਂ ਦੇ ਰਹੀ ਇਸ ਵਾਰ ਮੈਂ ਫੋਨ ਕੱਟ ਕਰ ਦਿੱਤਾ ਮੈਨੂੰ ਇਹ ਪ੍ਰੋਡਕਟ ਲੈ ਕੇ ਬਹੁਤ ਅਜੀਬ ਜਿਹਾ ਮਹਿਸੂਸ ਹੋਇਆ ਕਿ ਐਨੇ ਮਹਿੰਗੇ ਪ੍ਰੋਡਕਟ ਨੇ ਅਤੇ ਐਨੀ ਮਾੜੀ ਕੁਆਲਿਟੀ ਉਸੇ ਟਾਈਮ ਹੀ ਮੈਂ ਇਸ ਨੂੰ ਵਾਪਸ ਕਰਨ ਦਾ ਮੂਡ ਬਣਾ ਲਿਆ ਅਤੇ ਨਾਲ ਹੀ ਰਿਟਰਨ ਪਾ ਦਿੱਤੀ